ਪੰਜਾਬ ਵਿੱਚ ਜਿੰਨੀਆਂ ਵੀ ਟੈਕਨੋਲੋਜੀ ਆਈਆਂ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਤਾਂ ਘੱਟ ਹੀ ਕੀਤਾ ਬਟ ਉਹਨੂੰ ਗਲਤ ਰਾਹ 'ਚ ਜ਼ਿਆਦਾ ਹੀ ਪਾਇਆ ਗਿਆ ਅੱਜ ਕੱਲ੍ਹ ਦੇ ਬੱਚੇ ਜਿੱਦਾਂ ਅਸੀਂ ਮੋਬਾਈਲ ਹੀ ਲੈ ਲਈਏ ਮੋਬਾਈਲ ਤੋਂ ਸਿੱਖਣ ਦੀ ਬਜਾਏ ਉਹਦਾ ਗਲਤ ਉਪਯੋਗ ਕਰਦੇ ਆ ਬੱਚਿਆਂ ਨੂੰ ਨਵੀਂ ਨਵੀਂ ਟੈਕਨੋਲੋਜੀ ਦੇ ਨਾਲ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਪਰ ਉਹ ਗਲਤ ਗੱਲਾਂ ਦੇ ਵਿੱਚ ਚਲੇ ਜਾਂਦੇ ਹਨ ਜਿਹਦੇ ਕਰਕੇ ਉਹਨਾਂ ਦੀ ਪੜ੍ਹਾਈ ਵੀ ਬੜੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਇਹਨਾਂ ਨੂੰ ਚਾਹੀਦਾ ਕਿ ਅਗਰ ਤੁਹਾਨੂੰ ਕੋਈ ਚੀਜ਼ ਮਿਲੀ ਹੈ ਉਹਦਾ ਸਹੀ ਉਪਯੋਗ ਕਰੋ ਨਾ ਕਿ ਉਹਨੂੰ ਮਿਸਯੂਜ ਕਰਕੇ ਤੁਸੀਂ ਗਲਤ ਰਸਤਿਆਂ 'ਚ ਪਓ